ਤਕਨਾਲੋਜੀ ਨੇ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਬਦਲਾਅ ਬਦਲਾਵ ਕੀਤਾ ਹੈ ਇ ਜਿਸ ਵਿੱਚ ਇੰਟਰਨੈੱਟ ਦੀ ਵਰਤੋਂ ਬਹੁਤ ਹੀ ਜ਼ਿਆਦਾ ਲਾਭਦਾਇਕ ਸਿੱਧ ਹੋਈ ਹੈ ਇੰਟਰਨੈੱਟ ਆਉਣ ਦੇ ਨਾਲ਼ ਬਹੁਤ ਜ਼ਿਆਦਾ ਸਮਾਂ ਵੀ ਬਚਿਆ ਹੈ ਅਤੇ ਬਹੁਤ ਹੀ ਜ਼ਿਆਦਾ ਤਰੱਕੀ ਵੀ ਕੀਤੀ ਗਈ ਹੈ ਇੰਟਰਨੈੱਟ ਦੀ ਵਰਤੋਂ ਨਾਲ਼ ਅਸੀਂ ਆਪਣੇ ਘਰ ਬੈਠੇ ਹੋਏ ਆਪਣੀ ਬੈਂਕਿੰਗ ਅਤੇ ਹੋਰ ਵੀ ਖ਼ਰੀਦਦਾਰੀ ਅਤੇ ਹੋਰ ਕਈ ਚੀਜ਼ਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਬੱਚਿਆਂ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਇੰਟਰਨੈੱਟ ਸਿੱਧ ਹੋਇਆ ਹੈ ਇਹਨਾਂ ਬੱਚਿਆਂ ਦੀ ਪੜ੍ਹਾਈ ਅਤੇ ਲਿਖਾਈ ਵਿੱਚ ਇੰਟਰਨੈੱਟ ਦੀ ਵਰਤੋਂ ਦਿਨ ਬ ਦਿਨ ਵੱਧਦੀ ਜਾ ਰਹੀ ਹੈ ਬੱਚਿਆਂ ਲਈ ਇੰਟਰਨੈੱਟ ਦੀ ਵਰਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਅਤੇ ਲਾਭਦਾਇਕ ਸਿੱਧ ਹੋ ਰਹੀ ਹੈ ਇੰਟਰਨੈੱਟ ਦੀ ਵਰਤੋਂ ਨਾਲ਼ ਅਸੀਂ ਘਰ ਬੈਠੇ ਆਪਣੇ ਆਵਾਜਾਈ ਦੇ ਸਾਧਨ ਅਤੇ ਉਹਨਾਂ ਦਾ ਸਮਾਂ ਅਤੇ ਟਿੱਕਟਾਂ ਵੀ ਬੁੱਕ ਕਰ ਸਕਦੇ ਹਾਂ ਅਤੇ ਕਿਤੇ ਜਾਣ ਲਈ ਰਸਤੇ ਵਿੱਚ ਰੁਕਣ ਲਈ ਹੋਟਲ ਰ ਵੀ ਅਸੀਂ ਇੰਟਰਨੈੱਟ ਤੋਂ ਹੀ ਬੁੱਕ ਕਰ ਸਕਦੇ ਹਾਂ ਅਤੇ ਹੋਰ ਵੀ ਕਿਸੇ ਇੰਟਰਨੈੱਟ ਦੀ ਵਰਤੋਂ ਨਾਲ਼ ਅਸੀਂ ਆਪਣਾ ਬਿੱਲ ਵੀ ਪੇਅ ਕਰ ਸਕਦੇ ਹਾਂ